ਹਾਂ ਕਿੱਦਾਂ ਵਧੀਆ ਵਧੀਆ ਬੜੇ ਦਿਨ ਹੋ ਗਏ ਨਾ ਹਾਲ ਨਾ ਚਾਲ ਕਿੱਥੇ ਰਹਿੰਦੀ ਆ ਅੱਜ ਕੱਲ੍ਹ ਅੱਛਾ ਘਰ ਹੀ ਹੁੰਦੀ ਹੈ ਮੈਂ ਵੀ ਬਸ ਘਰ ਹੀ ਹੁੰਦੀ ਹਾਂ ਵਿਹਲੇ ਬਸ ਮੈਂ ਸੋਚਦੀ ਸੀਗੀ ਕਿ ਕੁਛ ਨਾ ਸ਼ੁਰੂ ਕਰੀਏ ਕੋਈ ਸਟਾਰਟਅਪ ਸ਼ੁਰੂ ਕਰੀਏ ਬੜੇ ਲੋਕ ਕਰ ਰਹੇ ਅੱਜ ਕੱਲ੍ਹ ਹਾਂ ਮੈਂ ਨਾ ਉਹ ਗ੍ਰੈਫਿਕ ਡਿਜ਼ਾਇਨਿੰਗ ਦਾ ਡਿਪਲੋਮਾ ਕੀਤਾ ਸੀ ਕੁਛ ਚਿਰ ਪਹਿਲੇ ਮੈਂ ਸੋਚਿਆ ਸੀ ਮੈਂ ਆਪਾਂ ਉਸੀ ਫੀਲਡ 'ਚ ਅੱਜ ਕੱਲ੍ਹ ਉਸ ਫੀਲਡ ਦੀ ਡਿਮਾਂਡ ਵੀ ਹੈਗੀ ਆ ਅਤੇ ਸਾਰੇ ਲੋਕ ਵੀਡੀਓ ਐਡੇਟਿੰਗ ਗ੍ਰੈਫਿਕ ਡਿਜ਼ਾਇਨਿੰਗ ਵੱਲ ਭੱਜ ਰਹੇ ਨੇ ਤੇਰਾ ਕੀ ਖਿਆਲ ਹੈ ਕੋਈ ਗੱਲ ਨਹੀਂ ਮੈਂ ਸਿਖਾ ਦੇਵਾਂਗੀ ਹੁਣ ਫੋਨ 'ਤੇ ਨਹੀਂ ਵਿਸਤਾਰ 'ਚ ਗੱਲਾਂ ਵੀ ਨਹੀਂ ਨਾ ਹੋਣੀਆਂ ਤੂੰ ਆ ਕਿਸੇ ਦਿਨ ਆ ਮੇਰੇ ਵੱਲ ਸ਼ਾਮੀ ਆ ਜਾ ਫਿਰ ਮੈਂ ਤੈਨੂੰ ਬਹਿ ਕੇ ਸਮਝਾ ਦੇਵਾਂਗੀ ਨਾਲੇ ਆਪਾਂ ਆਪਣਾ ਸਟਾਰਟਅਪ ਕਰੀਏ ਵਧੀਆ ਤਰੀਕੇ ਤੇਰਾ ਵੀ ਕੁਛ ਬਣੇ ਅਤੇ ਮੇਰਾ ਵੀ ਕੁਛ ਬਣ ਜਾਵੇ ਕੋਈ ਨਾ ਕੋਈ ਨਾ ਆ ਚਲ ਠੀਕ ਆ